ਹਾਂਜੀ ਅਸੀਂ ਗੀਤ ਸੁਣਨਾ ਪਸੰਦ ਕਰਦੇ ਹਾਂ ਅਸੀਂ ਕ ਜਿਹੜੇ ਸੰਗੀਤ ਜ਼ਿਆਦਾਤਰ ਸੁਣਨਾ ਪਸੰਦ ਕਰਦੇ ਹਾਂ ਉਹ ਸੂਫੀ ਸੰਗੀਤ ਆ ਅਤੇ ਮੇਰਾ ਜਿਹੜਾ ਮਨਪਸੰਦ ਦਾ ਗਾਇਕ ਹੈ ਉਹ ਪੰਜਾਬੀ ਸਿੰਗਰ ਦਲਜੀਤ ਹੈ ਦਲਜੀਤ ਸਿੰਘ ਹੈ ਅਤੇ ਇੱਥੇ ਜਿਹੜਾ ਪੰਜਾ ਇੱਥੋਂ ਦਾ ਸਥਾਨਕ ਸੰਗੀਤ ਹੈ ਉਹ ਲੋਕ ਬੋਲੀ ਲੋਕ ਬੋਲੀਆਂ ਨੇ ਪੰਜਾਬ ਦੀਆਂ